ਮੈਂ ਬਜ਼ਾਰ ਤੋਂ ਡੋਮਸ ਦੇ ਇਕਰੈਲਿਕ ਕਲਰ ਖਰੀਦੇ ਸੀ ਜਿਨ੍ਹਾਂ ਦੀ ਸਮੂਥਿੰਗ ਬਹੁਤ ਵਧੀਆ ਸੀ ਉਹਨਾਂ ਨਾਲ ਮੈਨੂੰ ਬਰੱਸ਼ਿਜ਼ ਵੀ ਫਰੀ ਮਿਲੇ ਸਨ ਕਲਰਸ ਦੇ ਕੌਂਬੀਨੇਸ਼ਨ ਕਾਫੀ ਵਧੀਆ ਜਾ ਰਹੇ ਸੀ ਅਤੇ ਜਿਹੜੀ ਮੈਂ ਉਹਦੇ ਨਾਲ ਪੇਟਿੰਗ ਬਣਾਈ ਉਹਦਾ ਰਿਜਲਟ ਵੀ ਕਾਫੀ ਵਧੀਆ ਆਇਆ